ਜਿੱਦਾਂ ਕਿ ਸਾਡੇ ਨੇੜਲੇ ਕੋਲਜ ਪੰਡਿਤ ਮੋਹਨ ਲਾਲ ਸ਼੍ਰੀ ਦੇਵੀ ਕੋਲਜ ਵਿੱਚ ਕਈ ਤਰ੍ਹਾਂ ਦੇ ਕੋਰਸ ਉਪਲਬਧ ਹਨ ਜਿਹਨਾਂ ਵਿੱਚ ਬੀ ਐੱਸ ਸੀ ਨੋਨ ਮੈਡੀਕਲ ਬੀ ਸੀ ਏ ਬੀ ਏ ਬੀ ਕੋਮ ਐੱਮ ਏ ਡਿਪਲੋਮਾ ਇਨ ਸਟੀਚਿੰਗ ਐਂਡ ਟੇਲਰਿੰਗ ਐੱਮ ਏ ਪੰਜਾਬੀ ਐੱਮ ਕੋਮ ਐੱਮ ਸੀ ਏ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਕੋਰਸ ਆ ਉਹ ਇੱਥੇ ਉਪਲਬਧ ਹਨ ਪਰ ਜਿਹੜੇ ਵੱਡੇ ਵੱਡੇ ਕੋਰਸ ਨੇ ਜਿਵੇਂ ਬੀ ਟੈੱਕ ਆਈ ਟੀ ਬੀ ਟੈੱਕ ਸੀ ਐੱਸ ਸੀ ਬੀ ਟੈੱਕ ਮਕੈਨੀਕਲ ਐਂਡ ਐੱਮ ਬੀ ਬੀ ਐੱਸ ਪੀ ਐੱਚ ਡੀ ਹੋਰ ਵੀ ਕਈ ਜਿਹੜੇ ਵੱਡੇ ਵੱਡੇ ਕੋਰਸ ਨੇ ਉਹ ਇੱਥੇ ਉਪਲਬਧ ਨਹੀਂ ਹਨ ਇਹਨਾਂ ਸਾਰੇ ਕੋਰਸਾਂ ਨੂੰ ਕਰਨ ਦੇ ਲਈ ਵਿਦਿਆਰਥੀਆਂ ਨੂੰ ਦੂਰ ਦੁਰਾਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਜਿਵੇਂ ਉਹਨਾਂ ਨੂੰ ਅੰਮ੍ਰਿਤਸਰ ਦਿੱਲੀ ਬਠਿੰਡਾ ਜਲੰਧਰ ਦੂਰ ਦੂਰ ਸ਼ਹਿਰਾਂ ਵਿੱਚ ਜਾਣਾ ਪੈਂਦਾ ਜਿਹਨਾਂ ਕਰਕੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਵਾ ਉਹਨਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਅਤੇ ਹੋਰ ਵੀ ਉਹਨਾਂ ਨੂੰ ਜਿਹੜੇ ਦੂਰ ਦਰਾਡੇ ਸ਼ਹਿਰਾਂ ਵਿੱਚ ਜਾਂਦੇ ਨੇ ਉਹਨਾਂ ਨੂੰ ਉੱਥੇ ਹੋਸਟਲਾਂ ਵਿੱਚ ਰਹਿਣਾ ਪੈਂਦਾ ਅਤੇ ਹੋਰ ਵੀ ਬਹੁਤ ਜ਼ਿਆਦਾ ਸਾਰੇ ਕਮੀਆਂ ਜਿਹਨਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ